ਚੋਣਾਂ ਦੇ ਦੌਰਾਨ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਈ ਪਿੰਡਾਂ ਦੇ ਵਿੱਚ ਕਈ ਵਿਕਾਸ ਕਾਰਜ ਚੱਲ ਰਹੇ ਹਨ ਉਹ ਵੀ ਰੁਕ ਜਾਂਦੇ ਨੇ ਅਤੇ ਸਰਪੰਚਾਂ ਪੰਚਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਦਫਤਰੀ ਕੰਮ ਕਾਰਜ ਇ ਅਜਿਹੇ ਹੁੰਦੇ ਹਨ ਜੋ ਕਿ ਪਿੰਡ ਦੀਆਂ ਪੰਚਾਇਤਾਂ ਕਰਵਾਉਂਦੀਆਂ ਹਨ ਜਾਂ ਆਮ ਲੋਕ ਕਰਵਾਉਂਦੇ ਹਨ ਚੋਣਾਂ ਦੌਰਾਨ ਬਹੁਤ ਹੀ ਕੰਮ ਘੱਟ ਹੁੰਦੇ ਨੇ ਅਤੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜੋ ਵੀ ਕਿਸੇ ਵੀ ਤਰ੍ਹਾਂ ਦੇ ਵਿਕਾਸਾਂ ਦੇ ਕੰਮ ਕਾਰਜ ਹੁੰਦੇ ਨੇ ਅਤੇ ਆਮ ਜਨਤਾ ਦੇ ਕੰਮ ਹੁੰਦੇ ਨੇ ਉਹ ਚੋਣਾਂ ਦੌਰਾਨ ਬੰਦ ਹੋ ਜਾਂਦੇ ਨੇ ਅਤੇ ਆਮ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ